ਮੈਨੂੰ ਸਭ ਤੋਂ ਜ਼ਿਆਦਾ ਜੋ ਧਰਮ ਮਤਲਬ ਸਿੱਖ ਧਰਮ ਤੋਂ ਇਲਾਵਾ ਜੋ ਆਕਰਸ਼ਿਤ ਕਰਦਾ ਹੈ ਉਹ ਮੁਸਲਮਾਨ ਹੈ ਮਤਲਬ ਉਨ੍ਹਾਂ 'ਚ ਬਹੁਤ ਏਕਾ ਹੈ ਉਹ ਆਪਣੇ ਧਰਮ ਲਈ ਆਪਣੇ ਸੱਭਿਆਚਾਰ ਲਈ ਅੱਜ ਵੀ ਬਹੁਤ ਸਖ਼ਤ ਹਨ ਆਪਣੇ ਬੱਚਿਆਂ ਨਾਲ ਈਵਨ ਕਿ ਆਪਣੇ ਆਪ ਨਾਲ ਜੋ ਉਨ੍ਹਾਂ ਦੀਆਂ ਪਰੰਪਰਾਵਾਂ ਹੈ ਭਾਵੇਂ ਉਹ ਕੋਈ ਵੀ ਹੈ ਅੱਜ ਦੇ ਟਾਈਮ 'ਚ ਉਹ ਹਰ ਚੀਜ਼ ਉਹ ਨਿਭਾਉਂਦੇ ਹੈ ਅਤੇ ਦੂਜੇ ਧਰਮਾਂ ਤੋਂ ਜੋ ਤਿਉਹਾਰ ਜੋ ਹੈ ਹੌਲੀ ਹੀ ਹੈ ਬਸ ਇਹ ਹੀ ਹੈਗਾ ਮੇਰੇ ਅਕੋਰਡਿੰਗ